ਹਾਂਜੀ ਮੈਂ ਆਪਣੇ ਸੱਭਿਆਚਾਰ ਤੋਂ ਇਲਾਵਾ ਹੋਰ ਸੱਭਿਆਚਾਰ ਅਤੇ ਪਕਵਾਨਾਂ ਨੂੰ ਵੀ ਬੜਾ ਪਸੰਦ ਕਰਦੀ ਹਾਂ ਕਿਉਂਕਿ ਮੈਨੂੰ ਕੁਕਿੰਗ ਕਰਨਾ ਬਹੁਤ ਹੀ ਜ਼ਿਆਦਾ ਪਸੰਦ ਆ ਅਤੇ ਮੈਂ ਅਲੱਗ ਅਲੱਗ ਤਰ੍ਹਾਂ ਦੀਆਂ ਡਿਸ਼ਿਜ਼ ਨੂੰ ਮਤਲਬ ਸਿੱਖਦੀ ਹਾਂ ਉਹਨਾਂ ਨੂੰ ਬਣਾਉਂਦੀ ਹਾਂ ਅਤੇ ਮੈਨੂੰ ਵਧੀਆ ਵੀ ਲੱਗਦਾ ਕੁਕਿੰਗ ਕਰਨਾ ਕੁਕਿੰਗ ਮੇਰੀ ਇੱਕ ਹੈਬੀਟ ਹੈ ਜਿਹਦੇ ਨਾਲ ਮੈਂ ਆਪਣੇ ਘਰਦਿਆਂ ਨੂੰ ਜਾਂ ਆਪਣੇ ਗੁਆਂਡੀਆਂ ਨੂੰ ਕੁਕਿੰਗ ਚੀਜ਼ਾਂ ਬਣਾ ਕੇ ਦਿੰਦੀ ਹਾਂ ਜਿਹਦੇ ਨਾਲ ਉਹ ਖਾਂਦੇ ਆ ਉਹਨਾਂ ਨੂੰ ਵੀ ਵਧੀਆ ਮਹਿਸੂਸ ਹੁੰਦਾ ਹੈ ਅਤੇ ਮੈਨੂੰ ਵੀ ਉਹ ਮਤਲਬ ਚੀਜ਼ਾਂ ਬਣਾ ਕੇ ਇੱਕ ਬੜੀ ਵਧੀਆ ਫੀਲਿੰਗ ਆਉਂਦੀ ਹੈ ਗੁੱਡ ਫੀਲਿੰਗ ਆਉਂਦੀ ਹੈ ਕਿ ਮੈਂ ਸਾਰਿਆਂ ਲਈ ਮਤਲਬ ਇੰਨਾ ਵਧੀਆ ਖਾਣਾ ਬਣਾਉਂਦੀ ਹਾਂ ਅ ਸਭ ਤੋਂ ਪਹਿਲਾਂ ਕਿ ਜਿਵੇਂ ਸਭਿਆ ਸਭਿਆਚਾਰਿਕ ਫੂਡ ਜਿਵੇਂ ਕਿ ਫਾਸਟ ਫੂਡ ਹੋ ਗਿਆ ਫਾਸਟ ਫੂਡ ਮਤਲਬ ਕਿ ਸਾਡਾ ਖਾਣਾ ਨਹੀਂ ਹੈਗਾ ਉਹ ਬਾਹਰ ਦਾ ਖਾਣਾ ਹੈਗਾ ਜਿਵੇਂ ਵੈਸਟਰਨ ਹੋ ਗਿਆ ਜਾਂ ਫਿਰ ਸਾਊਥ ਚਾਈਨੀਜ਼ ਜਾਂ ਕੁਛ ਵੀ ਹੋ ਗਿਆ ਠੀਕ ਆ ਮੈਂ ਜ਼ਿਆਦਾਤਰ ਮਤਲਬ ਪਾਸਤਾ ਜਾਂ ਸੈਂਡਵਿਚ ਜਾਂ ਇੱਦਾਂ ਦੀਆਂ ਚੀਜ਼ਾਂ ਬਣਾਉਂਦੀ ਹਾਂ ਜਿੱਦਾਂ ਘਰ ਵਿੱਚ ਜਿੱਦਾਂ ਸਵੇਰੇ ਮੋਰਨਿੰਗ ਹੁੰਦੀ ਆ ਤਾਂ ਮੋਰਨਿੰਗ ਵਿੱਚ ਬ੍ਰੇਕਫਾਸਟ ਵਿੱਚ ਆਪਾਂ ਸੈਂਡਵਿਚ ਬਣਾ ਲੈਂਦੇ ਹਾਂ ਜਿਹਦੇ ਨਾਲ ਮਤਲਬ ਕਿ ਆਪਣਾ ਥੋੜ੍ਹਾ ਲਾਈਟ ਵੀ ਖਾਣਾ ਹੋ ਜਾਂਦਾ ਆ ਆਪਣਾ ਦਿਲ ਕਰਦਾ ਕੁਛ ਲਾਈਟ ਖਾਣ ਲਈ ਪਰਾਂਠੇ ਆਪਣਾ ਰੋਜ਼ ਰੋਜ਼ ਪਰਾਂਠੇ ਖਾ ਕੇ ਮਤਲਬ ਆਪਾਂ ਬੋਰ ਹੋ ਜਾਂਦੇ ਹਾਂ ਸਮਟਾਈਮ ਜਿਹੜੇ ਆਪਣੇ ਚਿਲਡਰਨਜ਼ ਹੈਗੇ ਬੱਚੇ ਹੈਗੇ ਉਹ ਬੋਰ ਹੋ ਜਾਂਦੇ ਠੀਕ ਆ ਸੋ ਆਪਣੇ ਜਿਹੜੇ ਪੇਰੈਂਟਸ ਹੈਗੇ ਆ ਜਾਂ ਮੈਂ ਆਪਣੇ ਘਰਦਿਆਂ ਨੂੰ ਮਤਲਬ ਸਵੇਰੇ ਸਵੇਰੇ ਕਈ ਵਾਰੀ ਸੈਂਡਵਿਚ ਬਣਾ ਦਿੰਦੀ ਹਾਂ ਕੋਲਡ ਸੈਂਡਵਿਚ ਬਣਾ ਦਿੰਦੀ ਹਾਂ ਕੋਈ ਵੀ ਸੈਂਡਵਿਚ ਬਣਾ ਦਿੰਦੀ ਹਾਂ ਠੀਕ ਆ ਦੁਪਹਿਰ ਨੂੰ ਜਿਵੇਂ ਸਾਡੇ ਘਰ ਕੋਈ ਪਾਰਟੀ ਹੋਵੇ ਜਾਂ ਕੋਈ ਕੋਈ ਵੀ ਸਾਡੇ ਘਰ ਕ ਅ ਆਇਆ ਹੋਵੇ ਠੀਕ ਹੈ ਮੈਂ ਉਹਨਾਂ ਲਈ ਪਾਸਤਾ ਬਣਾ ਲੈਂਦੀ ਹਾਂ ਪਾਸਤਾ ਮੇਰਾ ਉਹ ਬਹੁਤ ਹੀ ਫੇਵਰਿਟ ਖਾਣਾ ਹੈਗਾ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਮੈਂ ਮੋਸਟਲੀ ਪਾਸਤਾ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ ਸੋ ਬਾਹਰ ਦਾ ਖਾਣ ਨਾਲੋਂ ਜ਼ਿਆਦਾ ਮੈਂ ਘਰ ਬਣਾਉਂਦੀ ਹਾਂ ਠੀਕ ਆ ਪਾਸਤਾ ਜਿਵੇਂ ਆਪਾਂ ਮਤਲਬ ਕਿ ਕਈ ਤਰ੍ਹਾਂ ਦੇ ਪਾਸਤੇ ਹੁੰਦੇ ਆ ਮੈਨੂੰ ਨੈਪੋਲੀਅਨ ਪਾਸਤਾ ਬੜਾ ਜ਼ਿਆਦਾ ਪਸੰਦ ਹੈਗਾ ਹੈ ਮੈਂ ਘਰ ਹੀ ਆਪਣਾ ਸਾਰਾ ਸਮਾਨ ਲੈ ਆਉਂਦੀ ਹਾਂ ਅਤੇ ਬਣਾਉਂਦੀ ਹਾਂ ਅਤੇ ਆਪਣੇ ਘਰਦਿਆਂ ਨੂੰ ਵੀ ਖਵਾਉਂਦੀ ਹਾਂ ਅਤੇ ਆਪ ਵੀ ਖਾਂਦੀ ਹਾਂ ਅਤੇ ਉਹ ਮਤਲਬ ਕਿ ਜਿਹਦੇ ਨਾਲ ਮਤਲਬ ਮੇਰਾ ਫੂਡ ਮੈਨੂੰ ਵੀ ਪਤਾ ਹੁੰਦਾ ਹੈ ਕਿ ਉਹ ਹੈਲਦੀ ਹੈਗਾ ਕਿਉਂਕਿ ਮੈਂ ਖੁਦ ਬਣਾਇਆ ਮੈਨੂੰ ਖੁਦ ਪਤਾ ਉਹਨਾਂ ਵਿੱਚ ਵੈਜੀਸ ਪਾ ਲਾ ਕੁਝ ਵੀ ਪਾ ਲਓ ਅਤੇ ਹਾਂ ਮੈਂ ਬਾਹਰ ਦਾ ਖਾਂਦੀ ਬਾਹਰ ਦਾ ਖਾਣਾ ਵੀ ਬਹੁਤ ਪਸੰਦ ਕਰਦੀ ਹਾਂ ਠੀਕ ਆ ਪਰ ਮੈਂ ਆਪਣੇ ਸੱਭਿਆਚਾਰਕ ਖਾਣੇ ਨੂੰ ਵੀ ਬਹੁਤ ਜ਼ਿਆਦਾ ਪ੍ਰੈਫਰੈਂਸ ਦਿੰਦੀ ਹਾਂ ਕਿਉਂਕਿ ਪਰਾਂਠਾ ਤਾਂ ਪਰਾਂਠਾ ਹੀ ਹੈ